ਭਾਰਤ ਵਿੱਚ ਬਹੁਤ ਸਾਰੀਆਂ ਜੀਵਨ ਬੀਮਾ ਕੰਪਨੀਆਂ ਹਨ ਜਿਵੇਂ ਐੱਲ ਆਈ ਸੀ ਮੈਕਸ ਲਾਈਫ ਪਰਮੈਰਿਕਾ ਬਿਰਲਾ ਸਨ ਲਾਈਫ ਆਦਿ ਇਸ ਤੋਂ ਇਲਾਵਾ ਹੈਲਥ ਇੰਨਸ਼ੋਰੈਂਸ ਜਿਹਨੂੰ ਸਿਹਤ ਬੀਮਾ ਕਹਿੰਦੇ ਹਾਂ ਉਹਦੇ ਨਾਲ ਰਿਲੇਟਿਡ ਸਟਾਰ ਹੈਲਥ ਇੰਨਸ਼ੋਰੈਂਸ ਆਈ ਸੀ ਆਈ ਸੀ ਆਈ ਲੋਂਮਬਾੜ ਅਤੇ ਗੱਡੀਆਂ ਗੈਰ ਜੀਵਨ ਬੀਮਾ ਜਿਹਨੂੰ ਕਹਿੰਦੇ ਗੱਡੀਆਂ ਦਾ ਬੀਮਾ ਉਹਨਾਂ ਦੇ ਵਿੱਚ ਵੀ ਯੂਨਾਈਟਡ ਇੰਡੀਅਨ ਇੰਨਸ਼ੋਰੈਂਸ ਓਰੀਐਂਟਲ ਇੰਨਸ਼ੋਰੈਂਸ ਕੰਮ ਕਰ ਰਹੀਆਂ ਹਨ ਜੀਵਨ ਬੀਮਾ ਬੰਦੇ ਦੇ ਜੀਵਨ ਦੇ ਨਾਲ ਰਿਲੇਟਿਡ ਆ ਅਤੇ ਉਹਦੇ ਵਿੱਚ ਉਹਦਾ ਕਵਰ ਜਿਹੜਾ ਆ ਉਹ ਜਿੰਨੀ ਦੇਰ ਉਹ ਜਿਉਂਦਾ ਰਹਿੰਦਾ ਹੈ ਤਾਂ ਉਹ ਚੱਲਦਾ ਰਹਿੰਦਾ ਅਤੇ ਜੇ ਇੰਨ ਕੇਸ ਡੈੱਥ ਹੋ ਜਾਵੇ ਤਾਂ ਉਹਦੇ ਪੈਸੇ ਪਿੱਛੋਂ ਪਰਿਵਾਰ ਨੂੰ ਮਿਲ ਜਾਂਦੇ ਹਨ ਸਿਹਤ ਬੀਮਾ ਉਹ ਹੈ ਕਿ ਜਦੋਂ ਬੰਦਾ ਬਿਮਾਰ ਹੋ ਜਾਵੇ ਤਾਂ ਅਚਾਨਕ ਆਏ ਹਸਪਤਾਲ ਦੇ ਖਰਚਿਆਂ ਨੂੰ ਜਾਂ ਟੈਸਟਾਂ ਦੇ ਖਰਚਿਆਂ ਨੂੰ ਚੁੱਕਣ ਵਾਸਤੇ ਉਹ ਬੀਮਾ ਹੈਲਪਫੁੱਲ ਹੁੰਦਾ ਹੈ ਕਾਰ ਬੀਮਾ ਜਾਂ ਗੱਡੀ ਦੇ ਬੀਮਾ ਵੀ ਇਸ ਕਰਕੇ ਜ਼ਰੂਰੀ ਹੈ ਕਿ ਕੋਈ ਵੀ ਬੰਦਾ ਇਸ ਕਰਕੇ ਨਹੀਂ ਗੱਡੀ ਚਲਾਉਂਦਾ ਕਿ ਉਹਨੇ ਐਕਸੀਡੈਂਟ ਕਰਨਾ ਅਤੇ ਬੀਮਾ ਕਲੇਮ ਕਰਨਾ ਪਰ ਕਦੇ ਅਚਾਨਕ ਕਦੇ ਕੋਈ ਐਕਸੀਡੈਂਟ ਹੋ ਜਾਵੇ ਤਾਂ ਇਹ ਕਾਰ ਬੀਮਾ ਅਚਾਨਕ ਆਏ ਖਰਚਿਆਂ ਨੂੰ ਚੁੱਕਣ ਵਾਸਤੇ ਬੜਾ ਮੱਦਦਗਾਰ ਸਾਬਿਤ ਹੁੰਦਾ ਹੈ